ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬ ਬਣਾਉਣ ਲਈ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਹਨ ਜਿਵੇਂ ਕਿ ਹਰੇਕ ਪਿੰਡ ਦੇ ਵਿੱਚ ਸਕੂਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜੇ ਕਿਤੇ ਬੱਚੇ ਘੱਟ ਹਨ ਤਾਂ ਨੇੜਲੇ ਪਿੰਡਾਂ ਵਿੱਚੋਂ ਬੱਸ ਦੀ ਸਹੂਲਤ ਸਰਕਾਰ ਦੁਆਰਾ ਦਿੱਤੀ ਗਈ ਹੈ ਅਤੇ ਸਕੂਲ ਦਾ ਜਿਹੜਾ ਇੰਨਫਰਾਸਟਕਚਰ ਹੈ ਉਹ ਪ੍ਰਾਈਵੇਟ ਅੰਗਰੇਜ਼ੀ ਸਕੂਲਾਂ ਦੀ ਤਰ੍ਹਾਂ ਬਣਾ ਰਹੇ ਹਨ ਅਤੇ ਉੱਥੇ ਪੇਰੈਂਟਸ ਟੀਚਰ ਮੀਟਿੰਗ ਜਿਸ ਵਿੱਚ ਅਧਿਆਪਕ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਮੀਟਿੰਗ ਕੀਤੀ ਜਾਂਦੀ ਹੈ ਉਹ ਵੀ ਜੋ ਕਿ ਅੰਗਰੇਜ਼ੀ ਸਕੂਲਾਂ ਦੇ ਵਿੱਚ ਹੋ ਰਿਹਾ ਸੀ ਸਰਕਾਰ ਉਹ ਸਾਰੀਆਂ ਹੀ ਸਹੂਲਤਾਂ ਸਰਕਾਰੀ ਸਕੂਲ ਵਿੱਚ ਦੇ ਰਹੀ ਹੈ ਅਤੇ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਸਕੂਲ ਜਾ ਰਹੇ ਹਨ ਹੁਣ ਜ਼ਮਾਨਾ ਬਦਲ ਗਿਆ ਹੈ ਕਿ ਮੁੱਠੀ ਭਰ ਬੱਚੇ ਸਕੂਲ ਨਹੀਂ ਭੇਜੇ ਜਾਂਦੇ ਹੁਣ ਹਰੇਕ ਸਕੂਲ ਦੇ ਵਿੱਚ ਹਰੇਕ ਪਿੰਡ ਦੇ ਵਿੱਚੋਂ ਘੱਟੋ ਘੱਟ ਸੱਤਰ ਅੱਸੀ ਪ੍ਰਸੈਂਟ ਬੱਚੇ ਸਕੂਲ ਜਾ ਰਹੇ ਹਨ ਹੁਣ ਉਹ ਜ਼ਮਾਨਾ ਗਿਆ ਹੈ ਕਿ ਪਿੰਡਾਂ ਦੇ ਖੇਤਰਾਂ ਦੇ ਬੱਚੇ ਸ਼ਹਿਰੀ ਖੇਤਰਾਂ ਦੇ ਨਾਲੋਂ ਪਿੱਛੇ ਹਨ ਜਿਵੇਂ ਕਿ ਅਸੀਂ ਦੇਖਿਆ ਹੀ ਹੈ ਦਸਵੀਂ ਅਤੇ ਬਾਰ੍ਹਵੀਂ ਦੇ ਜੋ ਬੋਰਡ ਦੇ ਨਤੀਜੇ ਆਏ ਹਨ ਉਸ ਵਿੱਚ ਪੇਂਡੂ ਖੇਤਰਾਂ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਮੱਲਾਂ ਮਾਰੀਆਂ ਹਨ ਅਤੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ ਕਿ ਪਿੰਡਾਂ ਵਿੱਚ ਰਹਿੰਦੇ ਲੋਕ ਵੀ ਸ਼ਹਿਰੀ ਖੇਤਰ ਵਿੱਚ ਵੱਸਦੇ ਲੋਕਾਂ ਨਾਲੋਂ ਕਿਸੇ ਪਾਸੋਂ ਘੱਟ ਨਹੀਂ